ਮੇਰੇ ਕੋਲ ਆਪਣੇ ਵੱਲੋਂ ਇਕੱਠਾ ਕੀਤਾ ਗਿਆ ਇੱਕ ਪੱਥਰ ਹੈ ਜੋ ਮੈਂ ਰਿਸ਼ੀਕੇਸ਼ ਵਿੱਚ ਜਦੋਂ ਘੁੰਮਣ ਗਿਆ ਸੀ ਆਪਣੇ ਪਰਿਵਾਰ ਨਾਲ ਉਦੋਂ ਮੈਂ ਇੱਕੱ ਚ ਚੁੱਕ ਕੇ ਲਿਆਇਆ ਸੀ ਅਤੇ ਇਹ ਪੱਥਰ ਕਾਫੀ ਹੀ ਅ ਸੋਹਣਾ ਹੈ ਅਤੇ ਇਸ ਨੂੰ ਮੈਂ ਆ ਕੇ ਰੰਗ ਕੀਤਾ ਅਤੇ ਇਹ ਬਹੁਤ ਹੀ ਸੁੰਦਰ ਲੱਗ ਰਿਹਾ ਸੀ ਅਤੇ ਇਸ ਨਾਲ ਅਤੇ ਇਹਨੂੰ ਘਰ ਵਿੱਚ ਸਜਾਵਟ ਵਿੱਚ ਰੱਖਿਆ ਗਿਆ ਹੈ ਅਤੇ ਇਹ ਇੱਕ ਤਾਂ ਗ ਉਸ ਸਮੇਂ ਦੀ ਇੱਕ ਨਿਸ਼ਾਨੀ ਹੈ ਉਸ ਸਮੇਂ ਦੀ ਯਾਦ ਹੈ ਅਤੇ ਅੱਜ ਵੀ ਇਹ ਮੈਂ ਸਾਂਭ ਕੇ ਰੱਖਿਆ ਗਿਆ ਹੋਇਆ ਹੈ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਮੈਨੂੰ ਆਪਣੇ ਪਿਤਾ ਜੀ ਦੇ ਨਾਲ ਜੋੜ ਕੇ ਰੱਖਦਾ ਹੈ